ਹਾਲ ਹੀ ਵਿੱਚ ਮੈਂ ਜੂਨੀਅਰ ਸਕੇਲ ਸ਼ਟੈਨੋਗ੍ਰਾਫੀ ਅਤੇ ਸ਼ਟੈਨੋ ਟਾਈਪਿਸਟ ਦਾ ਪੇਪਰ ਕਲੀਅਰ ਕੀਤਾ ਹੈ ਜਿਸ ਦੀ ਕਿ ਮੈਂ ਤਿੰਨ ਤੋਂ ਚਾਰ ਸਾਲ ਤੋਂ ਮਿਹਨਤ ਕਰਦਾ ਸੀ ਅਤੇ ਤਿਆਰੀ ਕਰਦਾ ਸੀ ਅਤੇ ਹੁਣ ਮੇਰੇ ਦੋਨੋਂ ਪੇਪਰ ਕਲੀਅਰ ਹੋ ਚੁੱਕੇ ਹਨ ਜਿਸ ਕਾਰਨ ਮੈਨੂੰ ਮੇਰੇ ਘਰਦਿਆਂ ਨੇ ਵੀ ਬਹੁਤ ਵਧਾਈਆਂ ਦਿੱਤੀਆਂ ਅਤੇ ਲੋਕਾਂ ਵਿੱਚ ਵੀ ਬਹੁਤ ਖੁਸ਼ੀ ਦੀ ਲਹਿਰ ਪੁੱਜ ਗਈ ਜਿਸ ਕਰਕੇ ਮੇਰੀ ਇਹ ਸਭ ਤੋਂ ਵੱਧ ਮਾਣ ਵਾਲੀ ਪ੍ਰਾਪਤੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅੱਗੇ ਮੈਂ ਸੀਨੀਅਰ ਸਕੇਲ ਸ਼ਟੈਨੋਗ੍ਰਾਫੀ ਦੀ ਤਿਆਰੀ ਕਰਾਂ ਅਤੇ ਉਸ ਵਿੱਚ ਵੀ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਾਂ